ਸੋਲ੍ਹਾਂ ਜੁਲਾਈ ਦੋ ਹਜ਼ਾਰ ਨੌਂ ਵੀਹ ਸਤੰਬਰ ਦੋ ਹਜ਼ਾਰ ਨੌਂ ਨਵੰਬਰ ਦੋ ਹਜ਼ਾਰ ਗਿਆਰਾਂ ਇਕੱਤੀ ਜੁਲਾਈ ਦੋ ਹਜ਼ਾਰ ਅਠਾਰਾਂ ਇਕੱਤੀ ਅਕਤੂਬਰ ਦੋ ਹਜ਼ਾਰ ਬਾਈ